ਹਾਂਜੀ ਸਾਨੂੰ ਪਾਣੀ ਦੀ ਸਪਲਾਈ ਮਿਲਦੀ ਹੈ ਪਹਿਲੇ ਸਮੇਂ ਵਿੱਚ ਜਿਵੇਂ ਕਿ ਪਾਣਾ ਦੀ ਸਪਲਾਈ ਨਹੀਂ ਹੁੰਦੀ ਸੀ ਪਾਣੀ ਬਾਹਰੋਂ ਟਿਊਵੈਲ ਖੂਹਾਂ ਆਦਿ ਤੋਂ ਲਿਆਂਉਦਾ ਜਾਂਦਾ ਸੀ ਪਰ ਹੁਣ ਜਿਵੇਂ ਹੀ ਪਾਣੀ ਦੀ ਸਪਲਾਈ ਆ ਗਈ ਹੈ ਇਸਕੇ ਇਸ ਕਾਰਨ ਪਾਣੀ ਦੀ ਸਪਲਾਈ ਟੂਟੀ ਦੀ ਵਰਤੋ ਦੇ ਨਾਲ ਕੰਮ ਜਿਹੜਾ ਸਾਡਾ ਜੀਵਨ ਬਹੁਤ ਹੀ ਸੁਖਾਲਾ ਅਤੇ ਬਹੁਤ ਹੀ ਸੌਖਾ ਹੋ ਗਿਆ ਹੈ ਇਸ ਦੇ ਨਾਲ ਕੰਮਾਂ ਕਾਰ ਕੰਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਘੱਟ ਟਾਈਮ ਲੱਗਦਾ ਹੈ ਅਤੇ ਸਾਰੇ ਕੰਮ ਕੋਈ ਵੀ ਕੰਮ ਹੈ ਜੋ ਕਿ ਚ ਚਾਹੇ ਕੱਪੜਿਆਂ ਦਾ ਹੋਵੇ ਚਾਹੇ ਸਫਾਈ ਦਾ ਹੋਵੇ ਚਾਹੇ ਖਾਣੇ ਦਾ ਹੋਵੇ ਚਾਹੇ ਬਰਤਨਾਂ ਦਾ ਹੋਵੇ ਉਹ ਬਹੁਤ ਜਲਦੀ ਅਤੇ ਘੱਟ ਟਾਈਮ ਦੇ ਵਿੱਚ ਹੋ ਜਾਂਦਾ ਹੈ ਇਸ ਲਈ ਜਿਹੜਾ ਜ ਟੂਟੀ ਦੇ ਪਾਣੀ ਵਰਤਣ ਦੇ ਨਾਲ ਜੀਵਨ ਬਹੁਤ ਹੀ ਸੌਖਾ ਅਤੇ ਵੱਖਰਾ ਅਨੁਭਵ ਹੁੰਦਾ ਹੈ ਕਿਉਂਕਿ ਪਹਿਲੇ ਟਾਈਮ ਦੇ ਵਿੱਚ ਜਿਹੜੇ ਲੋਕ ਨਲਕਿਆਂ ਦਾ ਉਪਯੋਗ ਕਰਦੇ ਸੀ ਜਾਂ ਘਰ ਦੇ ਬਾਹਰੋਂ ਟਿਊਵੈੱਲ ਖੂਹਾਂ ਆਦਿ ਦਾ ਉਪਯੋਗ ਕਰਕੇ ਕੰਮ ਕਰਦੇ ਸੀ ਉਹਨਾਂ ਦੇ ਜੀਵਨ ਵਿੱਚ ਕੰਮ ਕਰਨਾ ਮਤਲਬ ਬਹੁਤ ਔਖਾ ਸੀਗਾ ਹੁਣ ਦੇ ਟਾਈਮ ਵਿੱਚ ਟੂਟੀ ਦਾ ਪਾਣੀ ਵਰਤ ਕੇ ਕੰਮ ਨੂੰ ਸੁਖਾਲਾ ਬਣਾਇਆ ਗਿਆ ਹੈ ਇਸ ਲਈ ਜੀਵਨ ਟੂਟੀ ਦਾ ਪਾਣੀ ਵਰਤਣ ਦੇ ਨਾਲ ਬਹੁਤ ਹੀ ਸੌਖਾ ਹੈ